ਪੋਲਟਰੀ ਫਰਮ ਵਿੱਚ ਲੱਗਣ ਵਾਲੀਆ ਬਿਮਾਰੀਆਂ ਨਜ਼ਲਾ ਬਲਡ ਫਲੂ ਵਗੈਰਾ ਬਿਮਾਰੀਆਂ ਹੁੰਦੀਆਂ ਬਲਡ ਫਲੂ ਨਾਲ ਇਹ ਕਾਰੋਬਾਰ ਕਾਫੀ ਪ੍ਰਭਾਵਿਤ ਹੁੰਦਾ ਕਿਉਂਕਿ ਤਕਰੀਬਨ ਕਾਫੀ ਬੱਚੇ ਮੁਰਗੀਆਂ ਡੈਥ ਹੋ ਜਾਂਦੀ ਬਲਡ ਫਲੂ ਨਾਲ ਅਤੇ ਇਹਨਾਂ ਨਾਲ ਇਹਨਾਂ ਦੀ ਦੇਖ ਰੇਖ ਵੇਖਣ ਲਈ ਦੇਖ ਰੇਖ ਵਾਸਤੇ ਚਿੱਟਾ ਚੂਨਾ ਖਿਲਾਰਨਾ ਪੈਂਦਾ ਪੋਲਟਰੀ ਫਾਰਮ 'ਚ ਵੀ ਕੋਈ ਬਿਮਾਰੀ ਨਾਲ ਲੱਗੇ ਆਵੇ ਇਹਨਾਂ ਨੂੰ ਅਤੇ ਇਹਨਾਂ ਦਾ ਪਾਣੀ ਸਾਫ ਸੁਥਰਾ ਰੱਖਣਾ ਪੈਂਦਾ ਹੈਗਾ ਪਾਣੀ ਦੇ ਵਿੱਚ ਕੋਈ ਮੱਛਰ ਵਗੈਰਾ ਨਾ ਹੋਵੇ ਬਜ਼ਾਰ ਵਿੱਚੋਂ ਇਹਨਾਂ ਵਾਸਤੇ ਪੈਰਾਸਿਟਾਮੋਲ ਵਗੈਰਾ ਮੈਡੀਸਨ ਦੇਣੀ ਪੈਂਦੀ ਇਹਨਾਂ ਨੂੰ ਨਜ਼ਲੇ ਵਾਸਤੇ ਅਤੇ ਬਾਕੀ ਇਹਨੂੰ ਖਾਣ ਪੀਣ ਵਿੱਚ ਕਾਫੀ ਧਿਆਨ ਰੱਖਣਾ ਪੈਂਦਾ ਕੋਈ ਫੀਡ ਵਗੈਰਾ ਵਿੱਚ ਸਾਰਾ ਕੁਛ ਧਿਆਨ ਨਾਲ ਦੇਣੀ ਪੈਂਦੀ ਹੈ ਅਤੇ ਬਾਕੀ ਸਮੇਂ ਸਿਰ ਇਹਨਾਂ ਨੂੰ ਚੈੱਕ ਅਪ ਕਰਵਾਉਂਦੇ ਰਹਿਣਾ ਚਾਹੀਦਾ ਹੈਗਾ ਅਤੇ ਡਾਕਟਰ ਦਾ ਵੀ ਰਾਉਂਡ ਹੋਣਾ ਚਾਹੀਦਾ ਇੱਥੇ ਮਤਲਬ ਇਹਨਾਂ ਦੀ ਗਰਮੀ ਜ਼ਿਆਦਾ ਨਾ ਪੈਣ ਜ਼ਿਆਦਾ ਗਰਮੀ ਨੂੰ ਪੱਖੇ ਵਗੈਰਾ ਲਾਉਣੇ ਪੈਂਦੇ ਆ ਜ਼ਿਆਦਾ ਗਰਮੀ ਨਹੀਂ ਝੱਲ ਸਕਦੇ ਬੱਚੇ ਅਤੇ ਇਹਨਾਂ ਨੂੰ ਮਤਲਬ ਬਹੁਤ ਦੇਖ ਰੇਖ ਕਰਨੀ ਪੈਂਦੀ ਹਰੇਕ ਬਿਮਾਰੀ ਤੋਂ ਬਚਾਉਣ ਲਈ